ਮੇਰੇ ਹਰ ਸਮੇਂ ਦੀ ਮਨਪਸੰਦ ਪਕਵਾਨ ਆਲੂ ਦੇ ਪਰੌਂਠੇ ਹਨ ਮੈਂ ਆਲੂ ਦੇ ਪਰੌਂਠੇ ਨਾਸ਼ਤੇ ਵਿੱਚ ਖਾਣਾ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹਾਂ ਹਾਲਾਂਕਿ ਇਹ ਸਿਹਤ ਲਈ ਕੁਝ ਚੰਗੇ ਨਹੀਂ ਹੁੰਦੇ ਇਸ ਲਈ ਮੇਰੇ ਮਾਤਾ ਜੀ ਮੈਨੂੰ ਇਹ ਪਰੌਂਠੇ ਖਾਣ ਲਈ ਮਨ੍ਹਾਂ ਕਰਦੇ ਰਹਿੰਦੇ ਹਨ ਪਰ ਮੈਨੂੰ ਇਹ ਬਹੁਤ ਜ਼ਿਆਦਾ ਹੀ ਪਸੰਦ ਹਨ ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੀ ਮਿੰਨਤਾਂ ਕਰਦਾ ਰਹਿੰਦਾ ਹਾਂ ਕਿ ਉਹ ਹਫਤੇ ਦੇ ਵਿੱਚ ਇੱਕ ਵਾਰੀ ਤਾਂ ਮੈਨੂੰ ਆਲੂ ਦੇ ਪਰੌਂਠੇ ਜ਼ਰੂਰ ਖਵਾਉਣ ਇਸ ਲਈ ਮੇਰੇ ਬਹੁਤ ਜ਼ਿਆਦਾ ਕਹਿਣ 'ਤੇ ਮੇਰੇ ਮਾਤਾ ਜੀ ਮੇਰੇ ਲਈ ਐਤਵਾਰ ਨੂੰ ਆਲੂ ਦੇ ਪਰੌਂਠੇ ਬਣਾ ਦਿੰਦੇ ਹਨ ਜਦੋਂ ਮਾਤਾ ਜੀ ਆਲੂ ਦੇ ਪਰੌਂਠੇ ਸਵੇਰੇ ਬਣਾਉਣਾ ਸ਼ੁਰੂ ਕਰਦੇ ਹਨ ਤਾਂ ਉਹਨਾਂ ਉਸਨੂੰ ਦੇਖ ਕੇ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਚਾਅ ਚੜ੍ਹ ਜਾਂਦਾ ਹੈ ਅਤੇ ਮੇਰਾ ਮਨ ਬਹੁਤ ਖੁਸ਼ ਹੋ ਜਾਂਦਾ ਹੈ